ਵੈਸੇ ਤਾਂ ਸਾਨੂੰ ਲੜਾ ਲੜਨਾ ਹੀ ਨਹੀਂ ਚਾਹੀਦਾ ਪਰ ਅਗਰ ਕੁਛ ਹੋ ਵੀ ਜਾਂਦਾ ਹੈ ਤਣਾਅ ਕੁਛ ਹੋ ਵੀ ਜਾਂਦਾ ਹੈ ਤਾਂ ਰਾਜ ਸਰਕਾਰ ਵੱਲੋਂ ਵੱਖ ਵੱਖ ਬਣਾਏ ਗਏ ਹਨ ਜਿਵੇਂ ਛੋਟਾ ਮੋਟਾ ਜਾਂ ਕੁਛ ਲੜਾਈ ਝਗੜਾ ਪੁਲਿਸ ਸਟੇਸ਼ਨਾਂ ਦੇ ਵਿੱਚ ਖਤਮ ਕਰ ਦਿੱਤਾ ਜਾਂਦਾ ਹੈ ਸਲਾ ਸੁਲਹਾ ਕਰਵਾ ਦਿੱਤੀ ਜਾਂਦੀ ਹੈ ਲੋਕ ਅਦਾਲਤਾਂ ਦੇ ਅੰਦਰ ਤੁਸੀਂ ਸੁਲਹਾ ਕਰ ਸਕਦੇ ਹੋ ਕੋਰਟ ਦੇ ਅੰਦਰ ਤੁਸੀਂ ਸੁਲਹਾ ਕਰ ਸਕਦੇ ਹੋ ਆਪਣਾ ਨਿਆਏ ਸਮੀਤਾ ਤੁਹਾਨੂੰ ਇਹ ਸੁਲਹਾ ਕਰਵਾਉਂਦੀ ਹੈ ਅਤੇ ਪੁਲਿਸ ਸੁਵਿਧਾ ਕੇਂਦਰ ਹੁੰਦੇ ਹਨ ਜਿਹੜੇ ਉਹਨਾਂ ਦੇ ਵਿੱਚ ਤੁਸੀਂ ਕਰ ਸਕਦੇ ਹੋ ਇਹ ਵ ਇਹ ਚੀਜ਼ਾਂ ਪੰਜਾਬ ਸਰਕਾਰ ਵੱਲੋਂ ਬਣਾਈਆਂ ਗਈਆਂ ਹਨ ਜਿਵੇਂ ਕਿ ਅਗਰ ਪਿੰਡ ਦੇ ਇਲਾਕਿਆਂ ਦੇ ਅੰਦਰ ਕੁਛ ਤਨਾਅ ਹੁੰਦਾ ਹੈ ਤਾਂ ਉਹਦੇ ਲਈ ਪੰਚਾਇਤ ਸੁਲਹਾ ਕਰਵਾਉਂਦੀ ਹੈ ਅਤੇ ਵੈਸੇ ਤਾਂ ਤੁਹਾਨੂੰ ਇੰਨਾ ਤਨਾਅ ਕਰਨਾ ਹੀ ਨਹੀਂ ਚਾਹੀਦਾ ਲੜਨਾ ਹੀ ਨਹੀਂ ਚਾਹੀਦਾ ਕਿਉਂਕਿ ਫਿਰ ਅੱਗੇ ਜਾ ਕੇ ਕਈ ਵਾਰ ਮੁਸ਼ਕਿਲ ਹੋ ਜਾਂਦੀ ਹੁੰਦੀ ਹੈ ਪਰ ਇਹਨਾਂ ਚੀਜ਼ਾਂ ਤੋਂ ਹੀ ਬਚਣ ਲਈ ਸਾਨੂੰ ਸਾਡੀ ਰਾਜ ਸਰਕਾਰ ਨੇ ਸਾਡੀ ਪੰਜਾਬ ਸਰਕਾਰ ਨੇ ਪੁਲਿਸ ਸਟੇਸ਼ਨਜ਼ ਅਸ ਪ੍ਰੈਸ਼ਰ ਪੁਆਇੰਟਸ ਪ੍ਰੋਟੈਕਸ਼ਨ ਰਿਸਪਾਂਸ ਇੱਦਾਂ ਦੀਆਂ ਚੀਜ਼ਾਂ ਬਣਾਈਆਂ ਗਈਆਂ ਹਨ ਕਿ ਜਿਸ ਨਾਲ ਆਪਣੇ ਆਪਾਂ ਜੋ ਲੋਕ ਹਨ ਅੱਗੇ ਜਾ ਕੇ ਸਾਨੂੰ ਮੁਸ਼ਕਿਲ ਨਾ ਹੋਵੇ ਅਤੇ ਆਪਾਂ ਸੌਖੇ ਤਰੀਕੇ ਨਾਲ ਇਹਨਾਂ ਤਨਾਵਾਂ ਦਾ ਇਹਨਾਂ ਝਗੜਿਆਂ ਦਾ ਹੱਲ ਕਰ ਸਕੀਏ ਸੁਲਹਾ ਕਰ ਸਕੀਏ